ਦੌੜਨਾ ਛੋਟੇ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਏ ਆ ਕਿਉਂਕਿ ਦੌੜਨ ਦੇ ਨਾਲ਼ ਜਿਹੜਾ ਬੱਚਾ ਆ ਉਹ ਫੁਰਤੀਲਾ ਰਹਿੰਦਾ ਏ ਆ ਅਤੇ ਚੁਸਤ ਰਹਿੰਦਾ ਏ ਆ ਅਤੇ ਬੱਚਾ ਚੇਤੰਨ ਰਹਿੰਦਾ ਏ ਆ ਬੱਚਾ ਜਦੋਂ ਦੌੜਦਾ ਏ ਆ ਅਤੇ ਉਹ ਚੁਸਤ ਫੁਰਤ ਹੋ ਕੇ ਦੌੜਦਾ ਆ ਅਤੇ ਬੱਚੇ ਦਾ ਜਿਹੜਾ ਪੜ੍ਹਾਈ ਵਿੱਚ ਵੀ ਧਿਆਨ ਵਧੀਆ ਲੱਗਦਾ ਏ ਆ ਅਤੇ ਨਾਲ਼ੇ ਖੇਡਾਂ ਵਿੱਚ ਵੀ ਬੱਚੇ ਦਾ ਜਿਹੜੀ ਰੁਚੀ ਉਹ ਵੱਧਦੀ ਆ ਕਿਉਂਕਿ ਦੌੜਨ ਦੇ ਨਾਲ਼ ਜਿਹੜਾ ਬੱਚਾ ਏ ਆ ਉਹ ਗਰਾਊਂਡ ਦੇ ਵਿੱਚ ਜਦੋਂ ਦੌੜਦਾ ਆ ਤਾਂ ਉਹ ਚੁਸਤ ਫੁਰਤ ਰਹਿੰਦਾ ਏ ਆ ਅਤੇ ਬੱਚੇ ਦਾ ਜਿਹੜਾ ਖੇਡਾਂ ਵਿੱਚ ਵੀ ਰੁਝਾਨ ਜ਼ਿਆਦਾ ਰਹਿੰਦੇ ਕਿਉਂਕਿ ਬੱਚਾ ਫੁਰਤੀਲਾ ਹੁੰਦਾ ਏ ਆ ਅਤੇ ਦੌੜਨ ਵਿੱਚ ਬੱਚਾ ਜਿਹੜਾ ਹੈਗਾ ਉਹਨੂੰ ਅਸੀਂ ਖੇਡਾਂ ਦੇ ਵਿੱਚ ਵੀ ਪਾ ਸਕਦੇ ਹਾਂ